ਹਾਂਜੀ ਸਾਨੂੰ ਬਣਾਉਣ ਬੁਣਾਈ ਬੁਣਨ ਸਮੇਂ ਧਾਗੇ ਦੀ ਚੋਣ ਕਰਨ ਲਈ ਸਾਨੂੰ ਮਦਦ ਲੈਣੀ ਪੈਂਦੀ ਹੈ ਜੀ ਅਸੀਂ ਬੱਚਿਆਂ ਨੂੰ ਕਹਿ ਦਿੰਦੇ ਹਾਂ ਵੀ ਸਾਨੂੰ ਕੰਪੂਟਰ 'ਤੇ ਦਿਖਾ ਦਿਓ ਜੀ ਪੈਟਰਨ ਦੇਖਣਾ ਪੈਂਦਾ ਕੱਪੜੇ ਦਾ ਕਲਰ ਫਿਰ ਉਸ ਹਿਸਾਬ ਨਾਲ ਧਾਗੇ ਦਾ ਕਲਰ ਵੀ ਕਿਹੜੀ ਚੀਜ਼ ਕਿਹਦੇ ਉੱਪਰ ਜਚਦੀ ਆ ਜੇ ਜਚੇ ਧਾਗਾ 'ਤੇ ਹਰ ਕੱਪੜੇ ਦੀ ਮੈਚਿੰਗ ਸਹੀ ਹੋਵੇਗੀ ਤਾਂ ਤੁਹਾਡੀ ਥੋੜ੍ਹੀ ਕੀਤੀ ਹੋਈ ਕਢਾਈ 'ਤੇ ਮਿਹਨਤ ਵੀ ਜ਼ਿਆਦਾ ਦਿਖਣ ਲੱਗ ਜਾਂਦੀ ਆ ਇਸ ਲਈ ਮੈਚਿੰਗ ਬਹੁਤ ਜ਼ਰੂਰੀ ਆ ਵੀ ਕਿਹੜੇ ਕੱਪੜੇ 'ਤੇ ਕਿਹੜੇ ਕਿਹੜੇ ਕਲਰ ਜਚਦੇ ਨੇ ਉਹਨਾਂ ਨੂੰ ਦੇਖਣ ਲਈ ਸਾਨੂੰ ਜਾਂ ਤਾਂ ਕਿਸੇ ਕੱਪੜੇ ਦੇ ਉੱਪਰ ਪਹਿਲਾਂ ਸਾਨੂੰ ਧਾਗਿਆਂ ਦੇ ਕਲਰ ਰੱਖਣੇ ਪੈਂਦੇ ਨੇ ਦੇਖਣੇ ਪੈਂਦੇ ਨੇ ਵੀ ਇਹ ਜਚਦੇ ਨੇ ਪਰ ਅੱਜ ਕੱਲ੍ਹ ਦਾ ਚਲੋ ਕੰਪਿਊਟਰ ਦਾ ਯੁੱਗ ਆ ਗਿਆ ਹੈ ਅਸੀਂ ਬੱਚਿਆਂ ਨੂੰ ਕਹਿ ਦਿੰਨੇ ਆ ਸਾਨੂੰ ਕੰਪਿਊਟਰ ਖੋਲ ਕੇ ਕੰਪਿਊਟਰ ਵਿੱਚ ਮੈਚਿੰਗ ਦਿਖਾਓ ਵੀ ਕਿਹੜੀ ਮੈਚਿੰਗ ਜਚਦੀ ਆ ਕਿੱਦਾਂ ਜਚਦੀ ਆ ਜੇ ਉਹ ਜਚਨ ਅਨੁਸਾਰ ਅਸੀਂ ਕਰਦੇ ਹਾਂ ਨਾ ਤਾਂ ਉਹ ਹੋਰ ਚੀਜ਼ ਵੀ ਜ਼ਿਆਦਾ ਵਧੀਆ ਲੱਗਣ ਲੱਗ ਜਾਂਦੀ ਹੈ ਕਢਾਈ ਵਾਲੀ ਇਸ ਲਈ ਮੈਚਿੰਗ ਇੱਕ ਜ਼ਰੂਰੀ ਆ ਧਾਗੇ 'ਤੇ ਅਰ ਕੱਪੜੇ ਦੀ ਮੈਚਿੰਗ ਨੂੰ ਕੀਤੀ ਹੋਵੇ ਤਾਂ ਸਾਡਾ ਸੂਟ ਹੋਰ ਵੀ ਜਚੂਗਾ ਇਹ ਬਹੁਤ ਜ਼ਰੂਰੀ ਚੀਜ਼ ਹੈ ਦੇਖਣ ਵਾਸਤੇ